ਮੈਨੂੰ ਪੇਂਟਿੰਗ ਕਰਨ ਦਾ ਬਹੁਤ ਹੀ ਸ਼ੌਂਕ ਹੈ ਅਤੇ ਮੈਂ ਪੇਂਟਿੰਗ ਕਰਦਾ ਸਭ ਤੋਂ ਵਧੀਆ ਕਾਰਨ ਮੰਨਦਾ ਹਾਂ ਕਿ ਮੈਨੂੰ ਬਚਪਨ ਤੋਂ ਸ਼ੌਂਕ ਹੈ ਮੈਂ ਇਹ ਪੇਂਟਿੰਗ ਕਰਨਾ ਆਪਣੇ ਟੀਚਰਾਂ ਤੋਂ ਸਿੱਖਿਆ ਹਾ ਅਤੇ ਮੇਰੇ ਬਹੁਤ ਸਾਰੇ ਫਰੈਂਡ ਹਨ ਜੋ ਪੇਂਟਿੰਗ ਕਰਨਾ ਪਸੰਦ ਕਰਦੇ ਹਨ ਜਿਨ੍ਹਾਂ ਵਿੱਚੋਂ ਮੇਰਾ ਉਹ ਫਰੈਂਡ ਕਰਨ ਮਹਿਦਵਾਨ ਹੈ ਇਹ ਸ਼ੌਂਕ ਮੈਨੂੰ ਉਸ ਤੋਂ ਪਿਆ ਹੈ ਕਿਉਂਕਿ ਉਹ ਵੀ ਪੇਂਟਿੰਗ ਕਰਦਾ ਸੀ ਅਤੇ ਕਦੀ ਕਦੀ ਮੈਂ ਉਸ ਦੇ ਨਾਲ ਪੇਂਟਿੰਗ ਕਰਨ ਲੱਗ ਜਾਂਦਾ ਪਰ ਹੁਣ ਮੈਨੂੰ ਪੱਕਾ ਸ਼ੌਂਕ ਪੈ ਗਿਆ ਹੈ ਜਿਸ ਦੇ ਕਾਰਨ ਮੈਂ ਦਸਵੀਂ ਜਮਾਤ ਵਿੱਚ ਪੇਂਟਿੰਗ ਵਿੱਚ ਹਿੱਸਾ ਲਿਆ ਪੇਂਟਿੰਗ ਕਰਨ ਲਈ ਸਭ ਤੋਂ ਜ਼ਿਆਦਾ ਜ਼ਰੂਰੀ ਹੁੰਦਾ ਹੈ ਮਟੀਰੀਅਲ ਜੇ ਤੁਸੀਂ ਵਧੀਆ ਮਟੀਰੀਅਲ ਯੂਸ ਕਰੋਂਗੇ ਸਾਫ਼ ਸੁਥਰਾ ਤਾਂ ਪੇਂਟਿੰਗ ਤੁਹਾਡੀ ਬਹੁਤ ਹੀ ਵਧੀਆ ਬਣੇਗੀ ਜਿਹੜੇ ਰੰਗ ਹਨ ਉਹ ਨੀਟ ਐਂਡ ਕਲੀਨ ਹੋਣੇ ਚਾਹੀਦੇ ਹਨ ਅਤੇ ਸ਼ੇਡਸ ਜਿਹੜੇ ਤੁਸੀਂ ਯੂਸ ਕਰਦੇ ਹਨ ਉਹ ਸਾਫ਼ ਸੁਥਰੀਆਂ ਹੋਣ ਤਾਂ ਪੇਂਟਿੰਗ ਬਹੁਤ ਹੀ ਵਧੀਆ ਹੋਏ ਹੋਵੇਗੀ ਹੁਣ ਪੇਂਟਿੰਗ ਬਣਾਉਣ ਲਈ ਫੀਡਬੈਕ ਦੀ ਵਰਤੋਂ ਕਰਦਾ ਹਾਂ ਜਿਵੇਂ ਕਿ ਮੈਂ ਆਪਣੀ ਪੇਂਟਿੰਗਸ ਨੂੰ ਫੇਸਬੁਕ ਇੰਸਟਾਗ੍ਰਾਮ 'ਤੇ ਅਪਲੋਡ ਕਰਕੇ ਫੀਡਬੈਕ ਲੈਂਦਾ ਹਾਂ ਜਿਸ ਦੇ ਕਾਰਨ ਮੈਨੂੰ ਵਧੀਆ ਫੀਡਬੈਕ ਮਿਲਦੇ ਹਨ